ਰਿਟਾਇਰਡ ਅਤੇ ਬਜ਼ੁਰਗ ਲੋਕ ਜ਼ਿਆਦਾਤਰ ਘਰ ਵਿੱਚ ਫਰੀ ਹੋਣ ਕਰਕੇ ਕਾਫੀ ਬੋਰ ਹੋ ਜਾਂਦੇ ਹਨ ਲੇਕਿਨ ਇਹ ਟੀ ਵੀ ਅਤੇ ਇੰਟਰਨੈਟ ਨੇ ਉਹਨਾਂ ਦਾ ਕਾਫੀ ਮਨ ਲਾਇਆ ਰੱਖਿਆ ਹੈ ਟੀ ਵੀ ਵਿੱਚ ਉਹ ਕਾਫੀ ਚੀਜ਼ਾਂ ਦੇਖ ਸਕਦੇ ਹਨ ਜਿਵੇਂ ਆਪਣੇ ਆਸਥਾ ਦਾ ਚੈਨਲ ਦੇਖ ਸਕਦੇ ਹਨ ਜਿਸ ਕਰਕੇ ਉਹ ਆਪਣੇ ਧਾਰਮਿਕ ਵਿਚਾਰਾਂ ਨੂੰ ਸੁਣ ਸਕਦੇ ਹਨ ਲੋਕਾਂ ਦੇ ਅਤੇ ਯੋਗਾ ਦੇ ਆਸਣ ਦੇਖ ਸਕਦੇ ਹਨ ਅਤੇ ਕਈ ਚੀਜ਼ਾਂ ਮੂਵੀਜ਼ ਵਗੈਰਾ ਫਿਲਮਾਂ ਵਗੈਰਾ ਗਾਣੇ ਵਗੈਰਾ ਸੁਣ ਸਕਦੇ ਹਨ ਜੋ ਉਹਨਾਂ ਦੇ ਜ਼ਮਾਨੇ ਦੇ ਹੋਣ ਜੋ ਉਹਨਾਂ ਨੂੰ ਪਸੰਦ ਹੋਣ ਅਤੇ ਇੰਟਰਨੈਟ ਰਾਹੀਂ ਵੀ ਉਹ ਕਾਫੀ ਆਪਣੇ ਆਪ ਨੂੰ ਜਾਗਰੂਕ ਰੱਖ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਉਹਨਾਂ ਲਈ ਕਿਹੜੀਆਂ ਸਕੀਮਾਂ ਸਰਕਾਰ ਨੇ ਕੱਢੀਆਂ ਹਨ ਅਤੇ ਉਹਨਾਂ ਲਈ ਕਿਹੜੀਆਂ ਹੋਰ ਕੀ ਕੀ ਉਹ ਚੀਜ਼ਾਂ ਕਰ ਸਕਦੇ ਹਨ ਇੰਟਰਨੈੱਟ ਦੁਆਰਾ ਉਹਨਾਂ ਨੂੰ ਸਭ ਕੁਝ ਪਤਾ ਲੱਗਦਾ ਰਹਿੰਦਾ ਕਿ ਦੁਨੀਆ ਦੇ ਕਿਹੜੇ ਖੇਤਰ ਵਿੱਚ ਕੀ ਹੋ ਰਿਹਾ ਹੈ ਅਤੇ ਉਹਨਾਂ ਨੂੰ ਬਾਹਰ ਨਿਕਲਣ ਦੀ ਵੀ ਲੋੜ ਨਹੀਂ ਪੈਂਦੀ ਉਹ ਆਪਣੇ ਇੰਟਰਨੈੱਟ ਰਾਹੀਂ ਅੱਜ ਕੱਲ੍ਹ ਫੇਸਬੁੱਕ ਵਟਸਐਪ 'ਤੇ ਆਪਣੇ ਜਿਹੜਾ ਨਾਲ ਦੋਸਤ ਨੇ ਆਪਣੇ ਪਰਿਵਾਰ ਨਾਲ ਗੱਲਾਂ ਕਰ ਸਕਦੇ ਹਨ ਕਿਉਂਕਿ ਬਜ਼ੁਰਗ ਹੋਣ ਕਰਕੇ ਉਹ ਉਹਨਾਂ ਨੂੰ ਜ਼ਿਆਦਾ ਬਾਹਰ ਨਹੀਂ ਜਾਇਆ ਜਾ ਸਕਦਾ ਇਸ ਕਰਕੇ ਉਹ ਇੰਟਰਨੈਟ ਰਾਹੀਂ ਵੀਡੀਓ ਕੋਲ ਦੁਆਰਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨਾਲ ਗੱਲਾਂ ਕਰ ਸਕਦੇ ਹਨ ਜੋ ਉਹਨਾਂ ਤੋਂ ਦੂਰ ਰਹਿ ਰਹੇ ਹਨ ਇਹ ਇਸ ਤਰ੍ਹਾਂ ਇਹ ਟੀ ਵੀ ਅਤੇ ਇੰਟਰਨੈਟ ਬਜ਼ੁਰਗਾਂ ਅਤੇ ਰਿਟਾਇਰਡਾਂ ਲਈ ਬਹੁਤ ਲਾਭਦਾਇਕ ਹੈ